ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੇਰੇ ਦੋਸਤ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀਗਾ ਅਤੇ ਉਹ ਉਹਨੇ ਦੱਸਿਆ ਸੀਗਾ ਕਿ ਤੁਸੀਂ ਪਲੇਸਿਸ ਵਿਜਿਟ ਕਰਵਾਉਂਦੇ ਜੀ ਹਾਂਜੀ ਅਤੇ ਮੈਂ ਨਾ ਬਾਹਰੋਂ ਆਉਣਾ ਹੈ ਆ ਅਤੇ ਤੁਸੀਂ ਦੱਸੋ ਮੈਂ ਕਦੋਂ ਕੁ ਆਵਾਂ ਮਤਲਬ ਮੌਸਮ ਕਿਹੜਾ ਸਹੀ ਹੋਊਗਾ ਮੈਂ ਤਰਨਤਾਰਨ ਵਿਜਿਟ ਕਰਨਾ ਸੀਗਾ ਹਾਂਜੀ ਤਿੰਨ ਦਿਨਾਂ ਲਈ ਹਾਂਜੀ ਹਾਂਜੀ ਅੱਛਾ ਅਤੇ ਕਿਹੜੀਆਂ ਕਿਹੜੀਆਂ ਪਲੇਸਿਸ ਵਿਜਿ ਵਿਜਿਟ ਕਰਵਾਓਗੇ ਹਾਂਜੀ ਤਿੰਨ ਦਿਨ ਲਈ ਹਾਂਜੀ ਆਹੋ ਅੱਛਾ ਅੱਛਾ ਅੱਛਾ ਹੂੰ ਅੱਛਾ ਅਤੇ ਚਾਰਜਸ ਕਿੰਨੇ ਲਓਗੇ ਇਹਦੇ ਅੱਛਾ ਹਾਂਜੀ ਚਲੋ ਠੀਕ ਆ ਫਿਰ ਸਤਿ ਸ਼੍ਰੀ ਅਕਾਲ